ਕੱਲ੍ਹ ਜਦੋਂ ਅਚਾਨਕ ਹੀ ਸਾਡੇ ਘਰ ਮਹਿਮਾਨ ਆ ਗਏ ਸੀ ਅਤੇ ਉੱਧਰੋਂ ਮੰਮਾ ਵੀ ਘਰ ਨਹੀਂ ਸਨ ਤਾਂ ਫਿਰ ਮੈਨੂੰ ਇੱਕ ਤਰ੍ਹਾਂ ਨਾਲ ਆਪ ਹੀ ਮਹਿਮਾਨਾਂ ਦੇ ਲਈ ਰਸੋਈ ਘਰ ਵਿੱਚ ਜਾ ਕੇ ਉਹਨਾਂ ਦਾ ਸਾਰਾ ਸ਼ਾਨਦਾਰ ਖਾਣਾ ਜਿੱਦਾਂ ਮੈਂ ਸੋਚਿਆ ਸੀ ਕਿ ਦਾਲ ਬਣਾ ਲਵਾਂਗੀ ਅਤੇ ਹਲਵਾ ਦੇ ਦਿਆਂਗੀ ਤਾਂ ਮੈਨੂੰ ਇੱਕ ਤਰ੍ਹਾਂ ਨਾਲ ਬਣਾਉਣ ਦੀ ਆਫਤ ਹੀ ਆ ਗਈ ਸੀ ਤਾਂ ਕਰਕੇ ਫਿਰ ਜਦੋਂ ਮੈਂ ਬਣਾਉਣ ਲੱਗੀ ਦਾਲ ਤਾਂ ਮੈਂ ਦਸ ਪੰਦਰ੍ਹਾਂ ਮਿੰਟ ਬਾਅਦ ਦੇਖਿਆ ਤਾਂ ਕੁੱਕਰ ਦੇ ਵਿੱਚ ਸੀਟੀ ਨਹੀਂ ਆ ਰਹੀ ਸੀ ਤਾਂ ਮੈਂ ਬਹੁਤ ਜ਼ਿਆਦਾ ਘਬਰਾ ਗਈ ਸੀ ਅਤੇ ਮੈਨੂੰ ਮੁਸ਼ਕਲ ਪੈ ਗਈ ਸੀ ਕਿ ਹੁਣ ਮੈਂ ਕੀ ਕਰਾਂ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਨਹੀਂ ਬਣਾਉਣਾ ਆ ਰਿਹਾ ਸੀ ਐਨੇ ਨੂੰ ਮੈਂ ਫਿਰ ਹਲਵਾ ਬਣਾਉਣ ਲੱਗੀ ਤਾਂ ਫਿਰ ਜਦੋਂ ਹੀ ਮੈਂ ਹਲਵਾ ਬਣਾਉਣ ਦੇ ਲਈ ਕੜਾਹੀ ਦੇ ਵਿੱਚ ਤੇਲ ਪਾ ਕੇ ਸੂਜੀ ਨੂੰ ਥੋੜ੍ਹਾ ਭੁੰਨਿਆ ਅਤੇ ਘੀ ਪਾਇਆ ਤਾਂ ਫਿਰ ਐਨੇ ਨੂੰ ਉੱਧਰੋਂ ਦੀ ਗੁਆਂਢ ਦੇ ਵਿੱਚੋਂ ਮੇਰੇ ਨਾਲ ਰਹਿੰਦੇ ਇੱਕ ਆਂਟੀ ਜੀ ਆ ਗਏ ਅਤੇ ਉਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਮੇਰੀ ਮਦਦ ਕਰਵਾਈ ਅਤੇ ਦੱਸਿਆ ਕਿ ਸਭ ਕੁਝ ਠੀਕ ਬਣ ਰਿਹਾ ਕੁੱਕਰ ਦੇ ਵਿੱਚ ਸੀਟੀ ਵੀ ਸਹੀ ਆ ਜਾਵੇਗੀ ਥੋੜ੍ਹਾ ਵਕਤ ਲੱਗੇਗਾ ਤਾਂ ਫਿਰ ਸਾਰਾ ਸਹੀ ਚੱਲ ਰਿਹਾ ਸੀ ਕੰਮ ਅਤੇ ਉਸ ਤੋਂ ਬਾਅਦ ਜਿੱਦਾਂ ਹੀ ਸਾਰਾ ਕੰਮ ਹੋ ਗਿਆ ਮੈਂ ਸਾਰਾ ਮਹਿਮਾਨਾਂ ਨੂੰ ਜਾ ਕੇ ਪਰੋਸਿਆ ਜਦੋਂ ਮਹਿਮਾਨਾਂ ਨੂੰ ਸਾਰਾ ਮੈਂ ਹਲਵਾ ਅਤੇ ਦਾਲ ਪਰੋਸਿਆ ਜਿੱਦਾਂ ਹੀ ਉਹਨਾਂ ਨੇ ਸਭ ਨੇ ਖਾਣ ਖਾਣ ਦੀ ਬਹੁਤ ਜ਼ਿਆਦਾ ਖਾਣੇ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਸਭ ਨੂੰ ਖਾਣਾ ਬਹੁਤ ਜ਼ਿਆਦਾ ਸਵਾਦ ਲੱਗਿਆ ਅਤੇ ਸਭ ਨੇ ਦੋ ਦੋ ਵਾਰ ਪਵਾ ਕੇ ਖਾਣਾ ਖਾਇਆ